ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਬਾਈਕਿੰਗ ਲੋਕਾਂ ਦੇ ਜੀਵਨ ਅਤੇ ਭਾਈਚਾਰਿਆਂ 'ਤੇ ਕਿਵੇਂ ਸਕਾਰਾਤਮਕ ਪ੍ਰਭਾਵ ਪਾ ਸਕਦੀ ਹੈ ਆਪਾਂ ਜਦੋਂ ਬਾਈਕਿੰਗ ਜਾਂਦੇ ਹਾਂ ਅਤੇ ਆਪਾਂ ਇਕੱਲੇ ਤਾਂ ਨਹੀਂ ਜਾਂਦੇ ਆਪਾਂ ਇੱਕ ਲੋਕਾਂ ਦੇ ਗਰੁੱਪ ਨਾਲ ਜਾਂਦੇ ਹਾਂ ਆਪਾਂ ਜਦੋਂ ਬਾਈਕਿੰਗ ਜਾਂਦੇ ਹਾਂ ਨਵੇਂ ਨਵੇਂ ਥਾਵਾਂ 'ਤੇ ਜਾਂਦੇ ਹਾਂ ਨਵੇਂ ਨਵੇਂ ਲੋਕਾਂ ਨੂੰ ਮਿਲ ਸਕਦੇ ਹਾਂ ਅਤੇ ਜਿਹੜੇ ਆਪਣੇ ਨਾਲ ਲੋਕ ਹੁੰਦੇ ਹਨ ਉਹਨਾਂ ਨਾਲ ਆਪਾਂ ਖੁਸ਼ੀਆਂ ਮਨਾ ਸਕਦੇ ਹਾਂ ਨਵੀਂ ਨਵੀਂ ਜਗ੍ਹਾਵਾਂ 'ਤੇ ਘੁੰਮ ਸ ਸਕਦੇ ਹਾਂ ਅਤੇ ਆਪਣੇ ਵਿਚਲੀ ਨੇੜਤਾ ਵਧਾ ਸਕਦੇ ਹਾਂ ਇਸ ਕਰਕੇ ਆਪਣੇ ਜੀਵਨ ਵਿੱਚ ਭਾਈਚਾਰਿਆਂ ਵਿੱਚ ਵਧੀਆ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਅਸੀਂ ਭਾਰਤ ਦੇ ਸੱਭਿਆਚਾਰ ਇਲਾਕੇ ਬਾਰੇ ਜਾਣ ਸਕਦੇ ਹਾਂ ਆਪਾਂ ਭਾਰਤ ਵਿੱਚ ਘੁੰਮ ਕੇ ਜ਼ਿਆਦਾ ਘੁੰਮ ਕੇ ਔਰ ਇਲਾਕਿਆਂ ਬਾਰੇ ਜਾਣ ਕੇ ਉਹਨਾਂ ਦੇ ਲੋਕਾਂ ਨੂੰ ਮਿਲ ਕੇ ਹੁਣ ਉੱਥੇ ਤਾਂ ਖਾਣਾ ਖਾ ਕੇ ਆਪਾਂ ਉਹਨਾਂ ਦੇ ਸੱਭਿਆਚਾਰ ਅਤੇ ਇਲਾਕਿਆਂ ਬਾਰੇ ਜਾਣ ਸਕਦੇ ਹਾਂ ਧੰਨਵਾਦ